ਹੈਲੋ ਹਾਂਜੀ ਮੈਮ ਅਸੀਂ ਤੁਹਾਡੀ ਕੀ ਸਹਾਇਤਾ ਕਰ ਸਕਦੇ ਹਾਂ ਹਾਂਜੀ ਸਾਡੇ ਕੋਲ ਸਾਰੇ ਵਧੀਆ ਕੁਆਲਿਟੀ ਉੱਤਮ ਕੁਆਲਿਟੀ ਦੇ ਬੀਜ ਨੇ ਹਰ ਤਰ੍ਹਾਂ ਦੇ ਬੀਜ ਨੇ ਹਾਂਜੀ ਸਾਡੇ ਕੋਲ ਸਾਰੇ ਹੀ ਵਧੀਆ ਕੁਆਲਿਟੀ ਦੇ ਬੀਜ ਨੇ ਤੁਸੀਂ ਜਿਹੜੇ ਲੈਣੇ ਨੇ ਤੁਸੀਂ ਲੈ ਸਕਦੇ ਹੋ ਅਸੀਂ ਆਮ ਲੋਕਾਂ ਨੂੰ ਜਿੰਨੇ ਰੇਟਾਂ ਦੇ ਵਿੱਚ ਦੇਣੇ ਆ ਤੁਹਾਨੂੰ ਉਹਦੇ ਤੋਂ ਘੱਟ ਹੀ ਦੇਵਾਂਗੇ ਕੋਈ ਗੱਲ ਨਹੀਂ ਹਾਂਜੀ ਸਾਡੇ ਕੋਲ ਔਰਗੈਨਿਕ ਬੀਜ ਵੀ ਨੇ ਹਰ ਤਰ੍ਹਾਂ ਦੇ ਬੀਜ ਨੇ ਕਣਕ ਦੇ ਝੋਨੇ ਦੇ ਹਰ ਤਰ੍ਹਾਂ ਦੇ ਨਹੀਂ ਨਹੀਂ ਕੈਮੀਕਲਸ ਵਗੈਰਾ ਮੈਮ ਕੋਈ ਨਹੀਂ ਹੈਗੇ ਸਾਡੇ ਕੋਲ ਸਾਰੇ ਔਰਗੈਨਿਕ ਬੀਜ ਨੇ ਕਿਉਂਕਿ ਇਹ ਫਸਲਾਂ ਦੇ ਨਾਲ ਹੀ ਤਾਂ ਹੋਣਾ ਸਭ ਕੁਝ ਜੇ ਅਸੀਂ ਵਧੀਆ ਕੁਆਲਿਟੀ ਦੀ ਫਸਲ ਦਿੰਦੇ ਹਾਂ ਬੀਜ ਦਿੰਦੇ ਹਾਂ ਤਾਂ ਕਿ ਤੁਹਾਡੀ ਫਸਲ ਬਹੁਤ ਵਧੀਆ ਹੋਵੇ ਫਸਲ ਵਧੀਆ ਹੋਵੇਗੀ ਤਾਂ ਤੁਹਾਡੇ ਲਈ ਵੀ ਵਧੀਆ ਹਾਂਜੀ ਨਹੀਂ ਸਾਡੇ ਕੋਲ ਹਰ ਤਰ੍ਹਾਂ ਦੇ ਬੀਜ ਨੇ ਤੁਸੀਂ ਲੈ ਸਕਦੇ ਹੋ ਜਿਹੜੇ ਤੁਹਾਨੂੰ ਚਾਹੀਦੇ ਨੇ ਹਾਂਜੀ ਸਾਰੀ ਤਰ੍ਹਾਂ ਦੇ ਬੀਜ ਨੇ ਨਹੀਂ ਨਹੀਂ ਉਸ ਤੋਂ ਘੱਟ ਮਿਲੇਗਾ ਪਰ ਵਧੀਆ ਮਿਲੇਗਾ ਤੁਹਾਨੂੰ ਕੋਈ ਦਿੱਕਤ ਨਹੀਂ ਆਵੇਗੀ ਤੁਹਾਨੂੰ ਕੋਈ ਸ਼ਿਕਾਇਤ ਨਹੀਂ ਆਉਣੀ ਸਾਡੇ ਬੀਜਾਂ 'ਚ ਕਿਉਂਕਿ ਸਾਡੇ ਬੀਜ ਸਾਡੇ ਬੀਜ ਵੈਸੇ ਹੀ ਬਹੁਤ ਸਹੀ ਹੁੰਦੇ ਨੇ ਸਾਰਿਆਂ ਦੇ ਲਈ ਹਾਂਜੀ ਹਾਂਜੀ ਹਾਂਜੀ ਵਧੀਆ ਹੋਵੇਗੀ ਤੁਹਾਡੀ ਫਸਲ ਬਹੁਤ ਵਾਧੂ ਵਧੀਆ ਹੋਵੇਗੀ ਅਤੇ ਹਾਂਜੀ ਹਾਂਜੀ ਹਾਂਜੀ ਹਾਂਜੀ ਦੱਸ ਦਿਆਂਗੇ ਠੀਕ ਆ ਮੈਮ